ਜੀ ਹਾਂ ਅਸੀਂ ਉਹਨਾਂ ਲੋਕਾਂ ਬਾਰੇ ਇਤਿਹਾਸ ਦੇ ਪੰਨਿਆਂ ਵਿੱਚੋਂ ਪੜ੍ਹਿਆ ਹੈ ਜੋ ਲੜਾਈਆਂ ਦੇ ਹਿੱਸੇ ਵਜੋਂ ਵੱਖ ਵੱਖ ਖੇਤਰਾਂ ਵਿੱਚ ਚਲੇ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਤਿਹਾਸ ਵਿੱਚ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਜਿੱਥੇ ਸਿੱਧੂ ਘਾਟੀ ਸਭਿਅਤਾ ਹੋਈ ਉਸ ਅਸਥਾਨ ਉੱਪਰ ਆਰੀਅਨ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੇ ਹਮਲਾ ਕਰਨ ਤੋਂ ਉਪਰੰਤ ਇੱਥੋਂ ਦੇ ਮੂਲ ਵਸ਼ਿੰਦਿਆਂ ਨੂੰ ਇੱਥੋਂ ਭਜਾ ਦਿੱਤਾ ਉਹ ਇੱਥੋਂ ਪੂਰਵ ਵੱਲ ਚਲੇ ਗਏ ਜਿੱਥੇ ਉਹਨਾਂ ਨੂੰ ਦ੍ਰਾਵਿੜ ਲੋਕ ਕਿਹਾ ਜਾਂਦਾ ਹੈ ਜੋ ਇਹ ਲੋਕ ਇੱਥੇ ਰਹਿ ਗਏ ਤਾਂ ਇਤਿਹਾਸ ਵਿੱਚ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਉਹਨਾਂ ਨੂੰ ਵਰਨ ਵਿਵਸਥਾ ਵਿੱਚ ਵੰਡ ਕੇ ਸ਼ੂਦਰ ਦਾ ਖਿਤਾਬ ਦੇ ਦਿੱਤਾ ਗਿਆ ਅਤੇ ਹਜ਼ਾਰਾਂ ਸਾਲਾਂ ਤੱਕ ਉਹਨਾਂ 'ਤੇ ਜ਼ੁਲਮ ਕੀਤੇ ਗਏ ਇਸ ਤੋਂ ਅੱਗੇ ਜਾਈਏ ਤਾਂ ਭਾਰਤ ਦੇ ਇਤਿਹਾਸ ਵਿੱਚ ਮੁਗਲ ਕਾਲ ਦੌਰਾਨ ਬਹੁਤ ਜੰਗਾਂ ਹੋਈਆਂ ਯੁੱਧ ਹੋਏ ਔਰ ਹਰ ਯੁੱਧ ਵਿੱਚ ਅਫਗਾਨਿਸਤਾਨ ਤੋਂ ਆਏ ਧਾੜਵੀਆਂ ਨੇ ਭਾਰਤ ਦਾ ਰੱਜ ਕੇ ਨੁਕਸਾਨ ਕੀਤਾ ਪਰ ਪੰਦਰਵੀਂ ਸ਼ਤਾਬਤੀ ਵਿੱਚ ਸਤਾ ਦੀ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਤੋਂ ਉਪਰੰਤ ਇਸ ਖਿਤੇ ਵਿੱਚ ਨਵੀਂ ਰੌਸ਼ਨੀ ਨਵੀਂ ਚਿਣਗ ਪੈਦਾ ਹੋਈ ਤਿੰਨ ਸੋ ਸਾਲ ਦੇ ਗੁਰੂ ਇਤਿਹਾਸ ਨੇ ਇੱਥੋਂ ਦੇ ਲਤਾੜੇ ਹੋਏ ਲੋਕਾਂ ਨੂੰ ਭਾਵੇਂ ਉਹ ਵਰਨ ਵਿਵਸਥਾ ਦੇ ਸਨ ਭਾਵੇਂ ਮੁਗਲਾਂ ਦੇ ਲਤਾੜੇ ਹੋਏ ਸਨ ਉਹਨਾਂ ਵਿੱਚ ਅਣਖ ਗੈਰਤ ਪੈਦਾ ਕੀਤੀ ਹੌਂਸਲਾ ਪੈਦਾ ਕੀਤਾ ਜਿਸ ਨਾਲ ਉਹ ਜੰਗਾਂ ਅਤੇ ਯੁੱਧਾਂ ਵਿੱਚ ਅੱਗੇ ਵਧ ਕੇ ਲੜੇ ਆਪਣੀ ਇੱਜਤ ਆਵਰੂ ਧੀਆਂ ਭੈਣਾਂ ਦੀ ਰਾਖੀ ਕੀਤੀ ਅਤੇ ਆਪਣੀ ਸੰਸਕ੍ਰਿਤੀ ਨੂੰ ਬਚਾਉਂਦੇ ਹੋਏ ਜਿੱਤ ਪ੍ਰਾਪਤ ਕੀਤੀ ਇਸ ਦੌਰਾਨ ਹੀ ਇਸ ਜੰਗਾਂ ਯੁੱਧਾਂ ਵਿੱਚੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅੰਤ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਜ ਸਥਾਪਿਤ ਕੀਤਾ ਕਈ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਇਸ ਖਿੱਤੇ ਵਿੱਚੋਂ ਇੱਥੋਂ ਦਾ ਰਾਜਾ ਪੈਦਾ ਹੋਇਆ ਜਿਸ ਨੇ ਇੱਥੋਂ ਦੇ ਖਿੱਤੇ ਵਿੱਚ ਸ਼ਾਂਤੀ ਲਿਆਂਦੀ ਪਰ ਉਸ ਤੋਂ ਉਪਰੰਤ ਅੰਗਰੇਜ਼ੀ ਕਾਲ ਦੌਰਾਨ ਫਿਰ ਜੰਗਾਂ ਯੁੱਧਾਂ ਵਿੱਚ ਲੋਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਰਤ ਦੀ ਵੰਡ ਹੋਈ ਪਾਕਿਸਤਾਨ ਹਿੱਸਾ ਅੱਡ ਹੋਇਆ ਤਾਂ ਪੰਜਾਬ ਖਿੱਤੇ ਵਿੱਚ ਰਹਿਣ ਵਾਲੇ ਦਸ ਲੱਖ ਲੋਕਾਂ ਦੀ ਮੌਤ ਹੋਈ ਅਣਗਿਣਤ ਹੀ ਔਰਤਾਂ ਬੇਪਤ ਹੋਈਆਂ ਪਸ਼ੂ ਧੰਨ ਅਤੇ ਧਰਤੀ ਸਭ ਛੁੱਟ ਗਈ ਪਰਿਵਾਰ ਤਬਾਹ ਹੋ ਗਏ ਜੀਵਨ ਤਬਾਹ ਹੋ ਗਏ ਉਹਨਾਂ ਨੂੰ ਬੇਅੰਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ